ਮੈਂ ਪਟਿਆਲਾ ਸ਼ਹਿਰ ਵਿੱਚ ਰਹਿੰਦੀ ਹਾਂ ਜੇਕਰ ਮੈਂ ਬਠਿੰਡੇ ਸ਼ਹਿਰ ਦੀ ਗੱਲ ਕਰਾਂ ਤਾਂ ਉੱਥੇ ਦੇ ਉਹ ਬਠਿੰਡਾ ਸ਼ਹਿਰ ਇੰਨਾਂ ਡਿਵੈਲਪ ਨਹੀਂ ਹੋਇਆ ਵਿਆ ਤਾਂ ਕਰਕੇ ਉਹ ਇੰਨਾਂ ਓਨ ਉਹਨਾਂ ਦੇ ਇੰਨੇ ਸਕੂਲ ਵਧੀਆ ਡਿਵੈਲਪ ਨਹੀਂ ਹੈਗੇ ਜੇਕਰ ਮੈਂ ਆਪਣੇ ਪਟਿਆਲੇ ਸ਼ਹਿਰ ਦੇ ਸਕੂਲਾਂ ਦੀ ਗੱਲ ਕਰਾਂ ਤਾਂ ਉਹ ਬਹੁਤ ਹੀ ਵਧੀਆ ਹਨ ਅਤੇ ਉੱਥੇ ਬੱਚਿਆਂ ਨੂੰ ਮਿਡ ਡੇ ਮੀਲ ਵਗੈਰਾ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ ਬਹੁਤ ਹੀ ਵਧੀਆ ਸਾਫ਼ ਸੁਥਰਾ ਮਿਡ ਡੇ ਮੀਲ ਪ੍ਰੋਵਾਈਡ ਕਰਦੇ ਨੇ ਬੱਚਿਆਂ ਨੂੰ ਅਤੇ ਜੇ ਬਠਿੰਡੇ ਸ਼ਹਿਰ ਦੇ ਸਕੂਲਾਂ ਦੀ ਗੱਲ ਕਰੀ ਜਾਵੇ ਤਾਂ ਐਵੇਂ ਬਠਿੰਡੇ ਸ਼ਹਿਰ ਦੇ ਸਕੂਲ ਵੀ ਇੰਨੇ ਮਾੜੇ ਨਹੀਂ ਹਨ ਕਿਉਂਕਿ ਉਹ ਹਲੇ ਇੰਨੇ ਪੂਰੀ ਚੰਗੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਤਾਂ ਕਰਕੇ ਥੋੜ੍ਹਾ ਬਹੁਤਾ ਤਾਂ ਫ਼ਰਕ ਪੈਂਦਾ ਹੀ ਹੈ ਜੇਕਰ ਪਟਿਆਲੇ ਦੇ ਸੜਕਾਂ ਦੀ ਗੱਲ ਕਰੀ ਜਾਵੇ ਤਾਂ ਪਟਿਆਲੇ ਦੀਆਂ ਸੜਕਾਂ ਬਹੁਤ ਹੀ ਸਾਫ਼ ਸੁਥਰੀਆਂ ਅਤੇ ਐਨ ਵਧੀਆ ਹਾਈਵੇ ਹਾਈਵੇ ਨੇਗੇ ਜੇਕਰ ਬਠਿੰਡੇ ਸ਼ਹਿਰ ਦੀ ਗੱਲ ਕਰੀ ਜਾਵੇ ਸੜਕਾਂ ਦੀ ਤਾਂ ਉਹ ਬਹੁਤ ਹੀ ਉੱਭੜ ਖਾਬੜ ਸੜਕਾਂ ਟੁੱਟੀਆਂ ਫੁੱਟੀਆਂ ਹਨ ਕਿਉਂਕਿ ਇੰਨਾਂ ਡਿਵੈਲਪ ਹੋਣ ਦੇ ਕਾਰਨ ਸੜਕਾਂ ਬਹੁਤ ਹੀ ਖ਼ਰਾਬ ਨੇ ਪਟਿਆਲੇ ਸ਼ਹਿਰ ਦੀਆਂ ਸੜਕਾਂ ਬਹੁਤ ਹੀ ਵਧੀਆ ਨੇ